ਅੱਜ ਕੱਲ੍ਹ ਦਾ ਯੁੱਗ ਟੈਕਨੋਲਜੀ ਦਾ ਯੁੱਗ ਹੈ ਜਿਸ ਵਿੱਚ ਕਈ ਐਸੇ ਸਾਧਨ ਬਣ ਰਹੇ ਨੇ ਜਿਹਨਾਂ ਵਿੱਚ ਅਸੀਂ ਦੂਰ ਬੈਠੇ ਲੋਕਾਂ ਨਾਲ਼ ਔਨਲਾਈਨ ਹੀ ਮੀਟਿੰਗ ਕਰ ਸਕਦੇ ਹਾਂ ਸਾਨੂੰ ਕਿਤੇ ਜਾਣੀ ਨਹੀਂ ਪੈਂਦਾ ਹੈ ਜਿਸ ਦੇ ਕਈ ਫਾਇਦੇ ਨੇ ਕੋਵਿਡ ਵਿੱਚ ਮੈਂ ਵੀ ਇਸ ਚੀਜ਼ ਦਾ ਬਹੁਤ ਫਾਇਦਾ ਲਿਆ ਮੇਰਾ ਸਾਰਾ ਕੰਮ ਔਨਲਾਈਨ ਹੁੰਦਾ ਸੀਗਾ ਮੈਨੂੰ ਕਿਤੇ ਜਾਣਾ ਨਹੀਂ ਪੈਂਦਾ ਸੀ ਕਰੋਨਾ ਇੱਕ ਐਸੀ ਬਿਮਾਰੀ ਸੀਗੀ ਜਿਸ ਵਿੱਚ ਬੰਦਾ ਬੰਦੇ ਦੇ ਕੋਲ ਖੜਨ ਤੋਂ ਡਰਦਾ ਸੀ ਕਈਆਂ ਦੇ ਬਿਜਨਸ ਵੀ ਰੁਕੇ ਉਸ ਕਾਰਨ ਲੇਕਿਨ ਸਾਨੂੰ ਇਸ ਨਾਲ਼ ਕੋਈ ਫ਼ਰਕ ਨਹੀਂ ਪਿਆ ਕਿਉਂਕਿ ਅਸੀਂ ਆਪਣੀ ਜਿੰਨੇ ਵੀ ਕੰਮ ਸੀ ਪੇਮੈਂਟਸ ਔਨਲਾਈਨ ਕਰਦੇ ਸੀਗੇ ਕੋਈ ਮੀਟਿੰਗ ਕਰਨੀ ਹੈ ਔਨਲਾਈਨ ਕਰੀਦੀ ਸੀਗੀ ਸੋ ਇਸਦਾ ਬਹੁਤ ਫਾਈਦਾ ਹੈ ਸਾਨੂੰ ਵੀਡਿਓ ਕੋਲਿੰਗ ਮੈਂ ਕਈ ਵਾਰ ਵੀਡਿਓ ਕੋਨਫਰੰਸ ਕੀਤੀਆਂ ਨੇ ਕਈ ਅਸੀਂ ਸੀ ਐੱਸ ਸੀ ਸੈਂਟਰਾਂ ਨਾਲ਼ ਵੀ ਜੁੜੇ ਵੇ ਹਾਂ ਜਿਹਦੇ ਵਿੱਚ ਸਾਡੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਜਿਹੜੇ ਸੀ ਐੱਸ ਸੀ ਮੈਂਬਰਸ ਨੇ ਉਹ ਇਸ ਥਾਂ 'ਤੇ ਆ ਕੇ ਮੀਟਿੰਗ ਕਰਦੇ ਨੇ ਔਨਲਾਈਨ ਤੈਕਨੋਲਜੀ ਦਾ ਸਾਨੂੰ ਬਹੁਤ ਫਾਇਦਾ ਹੈ ਮੈਨੂੰ ਇਹਦੇ ਵਿੱਚ ਸਹੀ ਇਹ ਲੱਗਿਆ ਹੈ ਕਿ ਬੰਦਾ ਕਿਤੇ ਵੀ ਬੈਠ ਕੇ ਕਿਸੇ ਵੀ ਬੰਦੇ ਨਾਲ ਮੀਟਿੰਗ ਕਰ ਸਕਦਾ ਹੈ ਸਾਨੂੰ ਇਹ ਨਹੀਂ ਹੈ ਕਿ ਅਗਰ ਮੀਟਿੰਗ ਬੋਂਬੇ 'ਚ ਹੈ ਤਾਂ ਸਾਨੂੰ ਬੋਂਬੇ ਜਾਣਾ ਪੈਣਾ ਜਾਂ ਮਹਾਰਾਸ਼ਟਰ ਜਾਣਾ ਪੈਣਾ ਔਨਲਾਈਨ ਅਸੀਂ ਇੱਕ ਦੂਜੇ ਨਾਲ਼ ਕਨੈਕਟ ਹੋਕੇ ਵੀਡਿਓ ਕੋਨਫਰੰਸ ਰਾਹੀਂ ਆਪਣੀਆਂ ਗੱਲਾਂ ਰੱਖ ਸਕਦੇ ਹਾਂ ਅਤੇ ਗ਼ਲਤ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਕਈ ਵਾਰ ਸਾਨੂੰ ਨੈਟਵਰਕ ਦੇ ਇਸ਼ੂ ਕਾਰਨ ਕਈ ਮੀਟਿੰਗਸ ਨੂੰ ਰੀਸ਼ਡਊਲ ਕਰਨਾ ਪੈਂਦਾ ਹੈ ਜਾਂ ਫਿਰ ਵੇਟ ਕਰਨਾ ਪੈਂਦਾ ਹੈ ਕਿ ਕਦ ਸਾਨੂੰ ਪਰੋਪਰ ਨੈਟਵਰਕ ਮਿਲੇਗਾ ਸੋ ਮੈਂ ਤਾਂ ਨਾਈਨਟੀ ਨਾਈਨ ਪ੍ਰਸੈਂਟ ਇਹਦੇ ਨਾਲ਼ ਇਹਨੂੰ ਪਸੰਦ ਹੀ ਕਰਦਾ ਹੈ ਕਿਉਂਕਿ ਇਸ ਨੇ ਕਾਫ਼ੀ ਬੰਦਿਆਂ ਨੂੰ ਸਖਾਲਾ ਕਰ ਦਿੱਤਾ ਹੈ ਅਤੇ ਆਉਣ ਵਾਲ਼ੇ ਸਮੇਂ ਵਿੱਚ ਮੈਂ ਆਸ ਕਰਦਾ ਕਿ ਹੋਰ ਵੀ ਟੈਕਨੋਲਜੀ ਅੱਗੇ ਵੱਧੇਗੀ ਅਸੀਂ ਇੰਟਰਨੈਸ਼ਨਲ ਵੀ ਕਨੈਕਟ ਹੋਵਾਂਗੇ ਲੋਕਾਂ ਨਾਲ਼ ਇਸ ਟੈਕਨੋਲਜੀ ਰਾਹੀਂ ਸੋ ਮੇਰੇ ਲਈ ਇਹ ਟੈਕਨੋਲਜੀ ਬਹੁਤ ਹੀ ਵਧੀਆ ਹੈ